ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦਾ ਜੀ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਸ਼ਰ ਜ਼ਰੂਰ ਮਿਲੂਗੀ ਜੀ ਤੁਹਾਨੂੰ ਹਾਂਜੀ ਜੈਪੁਰ ਜਾਣਾ ਜੀ ਫੈਮਲੀ ਜਾ ਰਹੀ ਹੈ ਜੀ ਹਾਂਜੀ ਕੋਈ ਗੱਲ ਨਹੀਂ ਸਰ ਕਿੰਨੇ ਸੀਟਰ ਤੁਹਾਨੂੰ ਬੱਸ ਚਾਹੀਦੀ ਹੈ ਜੀ ਹਾਂ ਬੱਤੀ ਸੀਟਰ ਮਿਲ ਜੂਗੀ ਬੱਤੀ ਹਾਂ ਮਤਲਬ ਸਟਾਰਟਿੰਗ ਹੀ ਸਾਡੀ ਬੱਤੀ ਸੀ ਬੱਤੀ ਸੀਟਰ ਤੋਂ ਹੁੰਦੀ ਗੱਡੀ ਏ ਸੀ ਬੱਸ ਮਿਲੂਗੀ ਤੁਹਾਨੂੰ ਏ ਸੀ ਮਿਲੂਗੀ ਬਸ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਨੂੰ ਦਿਨ ਕਿੰਨੇ ਲੱਗਣਗੇ ਪੰਦਰਾਂ ਦਿਨ ਲੱਗਣਗੇ ਹੈਂ ਤੇ ਤੁਸੀਂ ਜੈਪੁਰ ਘੁੰਮਣਾ ਮਤਲਵ ਤੁਸੀਂ ਉੱਤੇ ਆਸੇ ਪਾਸੇ ਜੈਪੁਰ ਦੇ ਏਰੀਏ ਜਿੰਨੇ ਵੀ ਕਿਲ੍ਹੇ ਵਗੈਰਾ ਜਾਂ ਕੁਛ ਹੈ ਨਾ ਜਿੰਨਾ ਵੀ ਉੱਥੇ ਘੁੰਮਣ ਨੂੰ ਹੈਗਾ ਗਾ ਟੂਰਿਸਟ ਪਲੇਸ ਉਹਦੇ ਲਾਗੇ ਲਾਗੇ ਸਾਰੇ ਘੁੰਮਣੇ ਹੋਣਗੇ ਹਾਂ ਇਹਨਾਂ ਦਾ ਪਤਾ ਕੀ ਇਹ ਤਾਂ ਰੂਟੀਨ ਇਹ ਤਾਂ ਰੂਟੀਨ 'ਚ ਜਾਂਦੇ ਰਹਿੰਦੇ ਇਹਨਾਂ ਨੂੰ ਤਾਂ ਪਤਾ ਸਾਰਾ ਕੁਝ ਜਿਵੇਂ ਰਾਜਸਥਾਨ ਦੇ ਵਿੱਚ ਮਹਿੰਦੀਪੁਰ ਚਲੇ ਗਏ ਹੈ ਨਾ ਸਾਲਾਸਰ ਜਾ ਵੜੇ ਬਦਰੀ ਅਤੇ ਜੈਪੁਰ 'ਚ ਜਿੰਨੇ ਕਿਲ੍ਹੇ ਹੈ ਸਾਰਾ ਕੁਛ ਉਹ ਸਾਨੂੰ ਸਾਰਾ ਵਿਜਿਟ ਕਰਵਾ ਦੇਣਗੇ ਤੇ ਕੋਈ ਗੱਲ ਨਹੀਂ ਸਰ ਵੀ ਮੈਂ ਹਾਂ ਹਾਂਜੀ ਕੋਈ ਗੱਲ ਨਹੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਦਫ਼ਤਰ 'ਚ ਆਓਗੇ ਨਾ ਤੁਹਾਨੂੰ ਦੱਸ ਦਿਆਂਗੇ ਦਫ਼ਤਰ ਆਓਗੇ ਨਾ ਤੁਹਾਨੂੰ ਅਸੀਂ ਜਦੋਂ ਦੱਸ ਦਾਂਗੇ ਵੀ ਅਸੀਂ ਕਿਲੋਮੀਟਰ ਲਾਵਾਂ ਕਿਲੋਮੀਟਰ ਤੁਸੀਂ ਜੇ ਤੁਹਾਨੂੰ ਮਤਲਬ ਕਿਲੋਮੀਟਰ ਦੇ ਦਿਓ ਜੇ ਤੁਸੀਂ ਦਿਹਾੜੀ ਦੇਣੀ ਹੋਈ ਦਿਹਾੜੀ ਦੇ ਦਿਓ ਤੇਲ ਵੱਖਰਾ ਹੋਊਗਾ ਇਹਦੇ 'ਚ ਨਾਈਟਾਂ ਹੋਣਗੀਆਂ ਡਰਾਈਵਰ ਦੀਆਂ ਠੀਕ ਆ ਦਿਹਾੜੀ ਹੋਊਗੀ ਬੱਸ ਦਾ ਖਰਚਾ ਹੋਊਗਾ ਦਿਹਾੜੀ ਦਾ ਅਤੇ ਉਸ ਹਿਸਾਬ ਨਾਲ ਕਰ ਲਾਂਗੇ ਆਪਾਂ ਟੂਲ ਟੈਕਸ ਹੋਣਗੇ ਠੀਕ ਆ ਅਤੇ ਜੇ ਤੁਸੀਂ ਮਤਲਬ ਉਕਾ ਪੱਕਾ ਕਰਨਾ ਉਹ ਵੀ ਕਰ ਲਾਂਗੇ ਆਪਾਂ ਉਕਾ ਪੱਕਾ ਵੀ ਕਿਲੋ ਵੀ ਅੰਦਾਜਾ ਲਾ ਲਾਂਗੇ ਇੰਨੇ ਕਿਲੋਮੀਟਰ ਬੱਸ ਚੱਲ ਜਾਊਗੀ ਪਤਾ ਤਾਂ ਲੱਗ ਸਾਨੂੰ ਤੁਸੀਂ ਦੱਸੋਗੇ ਵੀ ਅਸੀਂ ਕਿਹੜੀ ਕਿਹੜੀ ਜਗ੍ਹਾ ਵੇਖੀਆਂ ਸੀ ਜਦੋਂ ਅਸ ਅਸੀਂ ਤੁਹਾਨੂੰ ਦੱਸ ਦਿਆਂਗੇ ਵੀ ਆਹ ਫਲਾਣੀ ਫਲਾਣੀ ਜਗ੍ਹਾ 'ਤੇ ਜੇ ਘੁੰਮ ਘੁੰਮਣ ਵਾਸਤੇ ਆ ਅਤੇ ਉਹ ਹਿਸਾਬ ਨਾਲ ਸਾਨੂੰ ਪਤਾ ਨਾ ਕਿੰਨੇ ਕਿਲੋਮੀਟਰ ਗੱਡੀ ਚੱਲਦੀ ਹੈ ਅਸੀਂ ਤੁਹਾਨੂੰ ਉਕਾ ਪੱਕਾ ਦੱਸ ਦਿਆਂਗੇ ਜੇ ਤੁਸੀਂ ਕਿਲੋਮੀਟਰ ਕਰਨਾ ਹੈ ਵੀ ਜਿੰਨੀ ਬੱਸ ਚੱਲ ਗਈ ਉਸ ਹਿਸਾਬ ਨਾਲ ਆਪਾਂ ਕਰ ਲਾਂਗੇ ਠੀਕ ਹੈ ਨਾ ਜੀ ਬਾਕੀ ਡਰਾਈਵਰ ਹੈਗੇ ਆ ਉਹਨਾਂ ਨੂੰ ਸਾਰਾ ਭੇਤ ਆ ਉੱਥੋਂ ਦਾ ਏਰੀਏ ਦਾ ਉਹ ਤੁਹਾਨੂੰ ਸਾਰੀਆਂ ਜਗ੍ਹਾ ਵਿਖਾ ਕੇ ਲਿਆਉਣਗੇ ਵਧੀਆ ਕੋਈ ਚੱਕਰ ਨਹੀਂ ਗਾ ਅਤੇ ਤੁਹਾਡਾ ਹਾਂਜੀ ਹਾਂਜੀ ਹਾਂਜੀ ਹਾਂ ਸਾਡਾ ਰੂਟੀਨ ਕੰਮ ਆ ਜੀ ਇਹ ਸਾਡਾ ਤਕਰੀਬਨ ਗੱਡੀਆਂ ਆਉਂਦੀਆਂ ਖੜ੍ਹਦੀਆਂ ਉਹ ਘੱਟ ਖੜ੍ਹਦੀਆਂ ਫਿਰ ਗੱਡੀਆਂ ਸਾਰੀਆਂ ਬੁੱਕ ਹੀ ਰਹਿੰਦੀਆਂ ਤਕਰੀਬਨ ਸਾਰੀਆਂ ਵੋਲਵੋ ਗੱਡੀਆਂ ਆਪਣੇ ਕੋਲ ਵਧੀਆ ਏ ਸੀ ਗੱਡੀਆਂ ਹੀ ਆ ਵਧੀਆ ਡਰਾਈਵਰ ਆ ਸਾਡੇ ਕੋਈ ਨਸ਼ਾ ਪਤਾ ਨਹੀਂ ਕਰਦੇ ਸਭ ਠੀਕ ਹੈ ਜੀ ਬਿਨਾਂ ਨਸ਼ੇ ਪੱਤੇ ਤੋਂ ਆ ਸਾਰੇ ਵੈਸ਼ਨੂੰ ਬੰਦੇ ਆ ਅਤੇ ਤੁਹਾਡਾ ਪੂਰਾ ਜਜਮਾਨ ਹੋਣਗੇ ਕੋਈ ਉਲਾਂਭਾ ਨਹੀਂ ਆਊਗਾ ਗਹਾਂ ਨੂੰ ਵੀ ਤੁਸੀਂ ਸਾਡੇ ਕੋਲ ਵਿਜ਼ਿਟ ਕਰੋਗੇ ਠੀਕ ਆ ਨਾ ਅਤੇ ਤੁਸੀਂ ਦਫ ਹਾਂ ਦਫ਼ਤਰ ਆਇਓ ਆਪਣੇ ਦਫ਼ਤਰ 'ਚ ਬਹਿ ਕੇ ਆਪਾਂ ਗੱਲ ਕਰ ਲਾਂਗੇ ਕੋਈ ਚੱਕਰ ਨਹੀਂ ਹਾਂ ਠੀਕ ਆ ਸਰ ਓਕੇ ਜੀ ਓਕੇ ਸਰ ਓਕੇ